ਔਰਤ ਨੂੰ ਅੱਜ ਦੇ ਸਮੇਂ 'ਚ ਕਾਫ਼ੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਵੀ ਔਰਤ ਨੂੰ ਮਰਦਾਂ ਤੋਂ ਘੱਟ ਸਮਝਦੇ ਨੇ ਲੋਕ ਅਤੇ ਇਹਨਾਂ ਗੱਲਾਂ ਕਰਕੇ ਉਹਨਾਂ ਨਾਲ ਬਹੁਤ ਜ਼ਿਆਦਾ ਦੁਰਵਿਵਹਾਰ ਕੀਤਾ ਜਾਂਦਾ ਹੈ ਅਸਲ ਵਿੱਚ ਨਰ ਅਤੇ ਨਾਰੀ ਸਮਾਜ ਦੇ ਮਹੱਤਵਪੂਰਨ ਅੰਗ ਹਨ ਇਹ ਦੋਵੇਂ ਰੱਬ ਦੇ ਪਹੀਏ ਹਨ ਇੱਕ ਦੀ ਘਾਟ ਕਰਕੇ ਦੂਸਰਾ ਪਹੀਆ ਵੀ ਬੇਕਾਰ ਹੋ ਕੇ ਰਹਿ ਜਾਂਦਾ ਹੈ ਪਰਿਵਾਰ ਨੂੰ ਚਲਾਉਣ ਦੇ ਲਈ ਨਰ ਅਤੇ ਨਾਰੀ ਦੋਹਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ ਅੱਜ ਦੇ ਸਮੇਂ ਵਿੱਚ ਦੋਵਾਂ ਨੂੰ ਬਰਾਬਰ ਮੰਨਿਆ ਜਾ ਰਿਹਾ ਹੈ ਅੱਜ ਦੀ ਨਾਰੀ ਹਰ ਖੇਤਰ ਵਿੱਚ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਚੱਲ ਰਹੀ ਹੈ ਅੱਜ ਅਜਿਹਾ ਕਿਹਾ ਜਾਂਦਾ ਹੈ ਕਿ ਖੇਤਰ ਵਿੱਚ ਨਾਰੀਵਾਦ ਚੜ ਕੇ ਪ੍ਰਵੇਸ਼ ਨਾਲ ਕੀਤਾ ਜਾਂਦਾ ਹੈ ਸਭ ਤੋਂ ਵੱਡੇ ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਵੀ ਨਾਰੀ ਪੁੱਜ ਚੁੱਕੀ ਹੈ ਉਹ ਜ਼ਮਾਨਾ ਜਾ ਚੁੱਕਾ ਹੈ ਜਦੋਂ ਔਰਤ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ ਰਿਸ਼ੀਆਂ ਮੁਨੀਆਂ ਦਾ ਕਹਿਣਾ ਹੈ ਕਿ ਜਿੱਥੇ ਔਰਤ ਦਾ ਆਦਰ ਅਤੇ ਸਨਮਾਨ ਕੀਤਾ ਜਾਂਦਾ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਬਾਰੇ ਬਹੁਤ ਕੁਝ ਕਿਹਾ ਹੈ ਜਿਵੇਂ ਕਿ ਉਹ ਦੱਸਦੇ ਹਨ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ਜਿਸ ਥਾਂ ਨਾਰੀ ਦਾ ਆਦਰ ਨਹੀਂ ਹੁੰਦਾ ਉੱਥੇ ਸਾਰੇ ਕੰਮ ਅਸਫ਼ਲ ਹੁੰਦੇ ਹਨ ਪਰਿਵਾਰ ਵਿੱਚ ਵੀ ਔਰਤ ਦਾ ਰੋਲ ਨਰ ਤੋਂ ਵੀ ਜ਼ਿਆਦਾ ਮਹੱਤਵਪੂਰਨ ਮੰਨਿਆ ਗਿਆ ਹੈ ਮਾਂ ਦੇ ਰੂਪ ਵਿੱਚ ਸੰਤਾਨ ਨੂੰ ਪਾਲਦੀ ਪਲੋਸਦੀ ਹੈ ਪਤਨੀ ਦੇ ਰੂਪ ਵਿੱਚ ਪਤੀ ਦੀ ਸੇਵਾ ਕਰਦੀ ਹੈ ਅਤੇ ਪੁੱਤਰੀ ਦੇ ਰੂਪ ਵਿੱਚ ਘਰ ਦੇ ਕੰਮਾਂ ਵਿੱਚ ਵੱਧ ਚੜ ਕੇ ਹੱਥ ਵਟਾਉਂਦੀ ਹੈ ਸੱਚੀ ਔਰਤ ਉਹ ਹੀ ਹੈ ਜੋ ਸਾਰੇ ਪਰਿਵਾਰ ਦੇ ਭੋਜਨ ਕੱਪੜੇ ਆਰਾਮ ਅਤੇ ਸਿਹਤ ਦਾ ਪੂਰਾ ਧਿਆਨ ਰੱਖੇ ਘਰ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਸੁਚੇਤ ਰਹੇ ਪਤੀ ਦੇ ਆਦੇਸ਼ ਦਾ ਪਾਲਣਾ ਕਰੇ ਸੰਤਾਨ ਦੀ ਇੱਛਾ ਪੂਰੀ ਕਰੇ ਵੱਡੇ ਅਤੇ ਬਜ਼ੁਰਗ ਲੋਕਾਂ ਦਾ ਆਦਰ ਅਤੇ ਸੇਵਾ ਕਰੇ ਭਾਰਤੀ ਔਰਤ ਦਾ ਇਹ ਵੀ ਆਦਰਸ਼ ਹੈ ਕਿ ਉਹ ਪਰਿਵਾਰ ਵਿੱਚ ਏਕਤਾ ਨੂੰ ਕਾਇਮ ਰੱਖੇ ਸਭ ਦੇ ਗਿਲੇ ਸ਼ਿਕਵੇ ਸੁਣ ਕੇ ਉਸ ਨੂੰ ਦੂਰ ਕਰਨ ਦਾ ਯਤਨ ਕਰੇ ਅਤੇ ਕਿਸੇ ਵੀ ਪਰਿਵਾਰ ਦੇ ਮੈਂਬਰ ਸ੍ਰੀ ਹੀਨਤਾ ਦੀ ਭਾਵਨਾ ਨਾ ਰੱਖੇ ਅੱਜ ਦੇ ਸਮੇਂ ਵਿੱਚ ਨਾਰੀ ਵੱਧ ਚੜ ਕੇ ਹਿੱਸਾ ਲੈਂਦੀ ਹੈ ਸਾਰੇ ਹੀ ਕੰਮਾਂ ਦੇ ਵਿੱਚ ਉਹ ਫੈਸ਼ਨ ਸਿਨੇਮਾ ਹੋਟਲ ਨਾਚ ਦੀ ਤਰਫ਼ ਆਕਰਸ਼ਿਤ ਹੋ ਰਹੀ ਹੈ ਨਵੀਂ ਸਦੀ ਵਿੱਚ ਨਾਰੀ ਨੇ ਨਵੀਂ ਗੱਲਾਂ ਗ੍ਰਹਿਣ ਕੀਤੀਆਂ ਹਨ ਪਰ ਆਪਣੀ ਸੀਮਾ ਵਿੱਚ ਰਹਿਣਾ ਜਰੂਰੀ ਹੈ ਕਿਉਂਕਿ ਔਰਤ ਦਾ ਸੀਮਾ ਤੋਂ ਬਾਹਰ ਜਾਣਾ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ ਅਤੇ ਸਾਡੀ ਸੰਸਕ੍ਰਿਤੀ ਦਾ ਦੂਜਾ ਰੂਪ ਵੀ ਔਰਤ ਹੈ